ਅਸੀਂ ਕਾਨੂੰਨੀ ਮੁੱਦਿਆਂ ਨਾਲ ਨਜਿੱਠਣ ਲਈ ਪਹਿਲਾਂ ਤਾਂ ਆਪਸੀ ਪ੍ਰੇਮ ਭਾਵ ਨਾਲ ਸਮਝਾਇਆ ਜਾਂਦਾ ਹੈ ਅਗਰ ਫਿਰ ਵੀ ਸੁਲਝ ਸਾਡੇ ਕੋਲੋਂ ਮਸਲਾ ਨਹੀਂ ਸੁਲਝਿਆ ਜਾਂਦਾ ਤਾਂ ਅਸੀਂ ਆਪਣੇ ਸ਼ਹਿਰ ਦੇ ਡਿਪਟੀ ਕਮਿਸ਼ਨਰ ਕੋਲ ਜਾਂਦੇ ਹਾਂ ਅਤੇ ਉਹਨਾਂ ਨੂੰ ਆਪਣੀ ਸਮੱਸਿਆ ਦੱਸਦੇ ਹੋਏ ਅਤੇ ਉਹ ਸਾਡੀ ਸਮੱਸਿਆ ਨੂੰ ਸੁਲਝਾਉਣ ਲਈ ਸਾਡੀ ਮਦਦ ਵੀ ਕਰਦੇ ਹਨ